ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਵਧੀਆ ਤੁਸੀਂ ਦੱਸੋ ਕਿਵੇਂ ਹੋ ਕੀ ਕਰ ਰਹੇ ਹੋ ਹਾਂਜੀ ਵਧੀਆ ਅਤੇ ਮੈਂ ਤੈਨੂੰ ਇਹਦੇ ਨਾਲ ਰਿਲੇਟਿਡ ਹੀ ਕੁਛ ਪੁੱਛਣਾ ਸੀਗਾ ਮੈਂ ਤਾਂ ਜਿਹੜੀਆਂ ਮੈਂ ਹੁਣ ਪੁੱਛਣਾ ਸੀ ਕਿ ਬੇਕਰੀਸ ਬਾਰੇ ਪੁੱਛਣਾ ਸੀ ਫਰੀਦਕੋਟ ਦੇ ਵਿੱਚ ਵੀ ਕਿਹੜੀਆਂ ਕਿਹੜੀਆਂ ਫੇਮਸ ਆ ਵੀ ਜਿੱਥੇ ਜਾ ਕੇ ਮੈਂ ਆਪਦੇ ਜਿਹੜੇ ਚੈਨਲ 'ਤੇ ਵਲੋਗਸ ਪਾ ਸਕਦੀ ਹਾਂ ਵੀ ਡਿਸ਼ਿਜ ਜਿਹਦੇ ਨਾਲ ਮੇਰੇ ਵਿਊਜ ਵਧਣ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਅੱਛਾ ਠੀਕ ਹੈ ਮੈਮ ਅਤੇ ਤੁਸੀਂ ਮੈਨੂੰ ਇਹਦਾ ਜਿਹੜਾ ਪਤਾ ਉਹ ਦੱਸ ਸਕਦੇ ਹੋ ਅਤੇ ਤੁ ਤੁਸੀਂ ਇੱਕ ਕੰਮ ਕਰਿਓ ਤੁਸੀਂ ਮੈਨੂੰ ਵਟਸਅਪ 'ਤੇ ਜਿਹੜਾ ਹੈਗਾ ਵੀ ਬੇਕਰੀਜ ਦੇ ਨਾਮ ਅਤੇ ਨਾਲ ਉਹਨਾਂ ਦਾ ਪਤਾ ਭੇਜ ਦਿਓ ਨਾਲ ਸਾਹਮਣੇ ਲਿਖ ਲਿਖ ਕੇ ਹਾਂਜੀ ਅਤੇ ਮੈਂ ਤੁਸੀਂ ਮੈਨੂੰ ਦੱਸੋ ਵੀ ਮੈਂ ਆਪਣੇ ਆਪਦੇ ਚੈਨਲ ਨੂੰ ਗਰੋ ਕਰਨ ਵਾਸਤੇ ਹੋਰ ਕਿਹੜੀ ਕਿਹੜੀਆਂ ਚੀਜ਼ਾਂ ਕਰਾਂ ਜੀ ਮੈਂ ਫਾਸਟ ਫੂਡ ਬਾਰੇ ਤਾਂ ਕਵਰ ਕਰ ਲਿਆ ਮੋਸਟਲੀ ਥੋੜ੍ਹੇ ਬਹੁਤ ਜਿਹੜੇ ਰਹਿੰਦੇ ਹੋਣਗੇ ਉਹਨਾਂ ਨੂੰ ਮੈਂ ਕਰ ਲਊਂ ਬਾਅਦ 'ਚ ਅਤੇ ਹਾਂਜੀ ਮੈਨੂੰ ਇਹ ਸੀ ਵੀ ਥੋੜ੍ਹਾ ਜਿਹਾ ਜਿਹੜਾ ਹੈਗਾ ਚੈਨਲ ਦੇ ਵਿੱਚ ਕੁਝ ਅਲੱਗ ਚੀਜ਼ ਪਾਈ ਜਾਵੇ ਅਤੇ ਲੋਕ ਮਿੱਠੇ ਖਾਣ ਦੇ ਵੀ ਸ਼ੌਕੀਨ ਹੁੰਦੇ ਨੇ ਬੜੇ ਹਾਂਜੀ ਅਤੇ ਤੁਸੀਂ ਤੁਸੀਂ ਕਦੇ ਖਾਧੇ ਆ ਠੀਕ ਠੀਕ ਅੱਛਾ ਜੀ ਠੀਕ ਆ ਅਤੇ ਤੁਸੀਂ ਮੇਰੇ ਨਾਲ ਚੱਲ ਪਉਗੇ ਕਿਸੇ ਦਿਨ ਅਤੇ ਤੁਸੀਂ ਕਿਹੜੇ ਕਿਹੜੇ ਦਿਨ ਤੁਸੀਂ ਹਾਂਜੀ ਹਾਂਜੀ ਮੈਨੂੰ ਤਾਂ ਇਹ ਸੀ ਵੀ ਵੱਧ ਤੋਂ ਵੱਧ ਲੋਕ ਮੇਰੇ ਜਿਹੜੇ ਹੈਗੇ ਚੈਨਲ ਨੂੰ ਸਬਸਕ੍ਰਾਈਬ ਕਰਨ ਲਾਇਕ ਕਮੈਂਟ ਕਰਨ ਤੁਸੀਂ ਵੀ ਅੱਗੇ ਚੱਲ ਕੇ ਉਹ ਸ਼ੇਅਰ ਸ਼ੁਅਰ ਕਰ ਦਿਆ ਕਰੋ ਮਿਹਨਤ ਤਾਂ ਜੀ ਪੂਰੀ ਆ ਕਰੀ ਜਾਂਦੇ ਹਾਂ ਬਸ ਹਾਂਜੀ ਠੀਕ ਠੀਕ ਠੀਕ ਹਾਂਜੀ ਮੈਂ ਵੀ ਸੁਣਿਆ ਵੀ ਜਿਹੜੇ ਡਰੀਮ ਬੇਕਰਸ ਵਾਲੇ ਇਹਨਾਂ ਦੀ ਪੇਸਟਰੀ ਵਗੈਰਾ ਕਾਫੀ ਟੇਸਟੀ ਹੁੰਦੀ ਆ

ਅੱਛਾ ਐਨੀ ਵਧੀਆ ਉਹ ਠੀਕ ਆ ਜੀ ਅਤੇ ਫਿਰ ਤੁਸੀਂ ਕ ਕੋਈ ਦਿਨ ਕੱਢ ਲਓ ਫਿਰ ਆਪਾਂ ਦੋਵੇਂ ਇਕੱਠੇ ਚੱਲਦੇ ਹਾਂ ਹਾਂਜੀ ਠੀਕ ਹੈ ਜੀ ਓਕੇ ਧੰਨਵਾਦ ਜੀ ਓਕੇ ਬਾਏ